ਹੈਲੋ ਮੈਮ ਸਤਿ ਸ਼੍ਰੀ ਅਕਾਲ ਮੈਂ ਨਾ ਤੁਸੀਂ ਮੇਰੀ ਡਿਊਟੀ ਲਗਾਈ ਸੀ ਟੀਚਰ ਅਤੇ ਮੈਂ ਕਾਫੀ ਟੀਚਰਾਂ ਦੇ ਜੋ ਪਰਫੋਰਮੈਂਸ ਦੇਖੀ ਅਤੇ ਉਹਨਾਂ ਵਿੱਚ ਕਈ ਟੀਚਰ ਤਾਂ ਬਹੁਤ ਮਿਹਨਤ ਦੇ ਨਾਲ ਬੱਚਿਆਂ ਨੂੰ ਪੜ੍ਹਾ ਰਹੇ ਨੇ ਅਤੇ ਉਹਨਾਂ ਵਿੱਚੋਂ ਕੁਝ ਟੀਚਰ ਜਿਹੜੇ ਨੇ ਉਹ ਆਪਣੀ ਸਹੀ ਤਰੀਕੇ ਨਾਲ ਪਰਫੋਰਮ ਨਹੀਂ ਕਰ ਰਹੇ ਜਿਹਦਾ ਬੱਚਿਆਂ 'ਤੇ ਗਲਤ ਇਫੈਕਟ ਪਵੇਗਾ ਤਾਂ ਉਹਨਾਂ ਵਿੱਚੋਂ ਹਾਂ ਹਾਂਜੀ ਹਾਂਜੀ ਉਹਨਾਂ ਵਿੱਚੋਂ ਜਿਵੇਂ ਮੋਹਿਤ ਕੁਮਾਰ ਜਿਹੜੇ ਮੈਥ ਦੇ ਟੀਚਰ ਨੇ ਉਹ ਆਪਣੇ ਸਹੀ ਤਰੀਕੇ ਨਾਲ ਪਰਫੋਰਮੈਂਸ ਬੱਚਿਆਂ ਨੂੰ ਨਹੀਂ ਅਦਾ ਕਰ ਰਹੇ ਅਤੇ ਤੁਸੀਂ ਉਹਨਾਂ ਨੂੰ ਥੋੜ੍ਹਾ ਜਿਹਾ ਕੁਛ ਸਮਝਾ ਦਿਓ ਤਾਂ ਕਿ ਜਿਹੜੇ ਬਾਹਰੋਂ ਕੋਈ ਇੰਸਪੈਕਸ਼ਨ 'ਤੇ ਕੋਈ ਆ ਗਿਆ ਤਾਂ ਉਹ ਫਿਰ ਟੀਚਰਾਂ ਦੇ ਜਿਹੜੀ ਪਰਫੋਰਮੈਂਸ ਆ ਤਾਂ ਜਦੋਂ ਚੈੱਕ ਕਰੇਗਾ ਤਾਂ ਉਹ ਗਲਤ ਉਹਨਾਂ ਕੋਲ ਫੀਡਬੈਕ ਜਾਏਗੀ ਤਾਂ ਮੈਂ ਤਾਂ ਆਹ ਆਪਣੇ ਤੁਸੀਂ ਮੇਰੀ ਡਿਊਟੀ ਲਾਈ ਸੀ ਮੈਂ ਆਪਣਾ ਇਹ ਨੈਤਿਕ ਫਰਜ ਸਮਝਦੇ ਹੋਏ ਤੁਹਾਨੂੰ ਦੱਸ ਰਿਹਾ ਜੀ ਤਾਂ ਹਾਂਜੀ ਠੀਕ ਹੈ ਜੀ

ਹਾਂਜੀ ਹਾਂਜੀ ਧੰਨਵਾਦ ਜੀ ਥੈਂਕ ਯੂ